ਮੈਂ ਬਚਪਨ ਤੋਂ ਹੀ ਬੌਰਡਿੰਗ ਸਕੂਲ ਵਿੱਚ ਪੜ੍ਹਾਈ ਕਰੀ ਹੈ ਬੌਰਡਿੰਗ ਸਕੂਲ ਆਰਮੀ ਵਾਲ਼ਾ ਸਕੂਲ ਹੈ ਜਿਸ ਵਿੱਚ ਉਹ ਸਾਨੂੰ ਸਵੇਰੇ ਹੀ ਉਠਾ ਕੇ ਕਰੌਸ ਕੰਨਟਰੀ ਲਗਵਾਉਂਦੇ ਸਨ ਕਰੌਸ ਕੰਨਟਰੀ ਇੱਕ ਇਹੋ ਜਿਹੀ ਦੌੜ ਹੈ ਜੋ ਕਿ ਤੁਹਾਨੂੰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਦੌੜ ਕੇ ਜਾਣਾ ਹੁੰਦਾ ਹੈ ਇਸ ਵਿੱਚ ਮੈਂ ਮਹੀਨੇ ਵਿੱਚ ਘੱਟੋ ਘੱਟ ਦੋ ਵਾਰ ਹਿੱਸਾ ਲੈਂਦਾ ਸੀ ਅਤੇ ਜਿਸ ਵਿੱਚ ਮੈਂ ਕਦੇ ਅੱਵਲ ਅਤੇ ਦੂਜੇ ਜਾਂ ਤੀਜੇ ਨੰਬਰ 'ਤੇ ਵੀ ਆ ਜਾਂਦਾ ਸੀ ਬਟ